ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਰੇਲਵੇ ਸਟੇਸ਼ਨ ਤਰਨ ਤਾਰਨ ਤੋਂ ਬੋਲਦੇ ਮੈਮ ਇਸ ਤਰ੍ਹਾਂ ਕਿ ਅਸੀਂ ਬੱਚਿਆਂ ਸਮੇਤ ਘੁੰਮਣ ਆ ਰਹੇ ਹਾਂ ਪੰਜਾਬ ਹਰਿਆਣੇ ਤੋਂ ਅਸੀਂ ਆ ਰਹੇ ਹਾਂ ਜੀ ਮੈਮ ਤਰਨ ਤਾਰਨ ਦੇ ਨੇੜੇ ਨੇੜੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਚੋਂ ਤੁਹਾਡੀ ਟਰੇਨ ਜਾਂਦੀ ਹੈਗੀ ਹੈ

ਮੈਮ ਟਾਈਮ ਕੀ ਹੋਊਗਾ ਟਾਈਮ ਮੈਮ ਕਿਨ ਕਿੰਨੇ ਕੁ ਵਜੇ ਜਾਂਦੀ ਹੋਊਗੀ ਟਰੇਨ

ਮੈਮ ਸੀਟਸ ਵਗੈਰਾ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਹਨਾਂ ਬੱਚੇ ਮੈਮ ਅਸੀਂ ਫਿਰ ਟਿਕਟਾਂ ਬੁੱਕ ਕਰਵਾ ਲੈਂਦੇ ਹਾਂ ਅਤੇ ਹਾਂਜੀ ਫਿਰ ਅਸੀਂ ਘੁੰਮ ਲਾਂਗੇ ਇਹਨਾਂ ਨਾਲ ਹਾਂਜੀ ਅਤੇ ਮੈਮ ਜਦੋਂ ਅਸੀਂ ਵਾਪਿਸ ਜਾਣਾ ਜਾਣਾ ਹੋਇਆ ਨਾ ਹਰਿਆਣੇ ਫਿਰ ਵਾਪਿਸ ਜਾਣਾ ਹੈ ਉੱਥੋਂ ਸਾਨੂੰ ਤਰਨ ਤਾਰਨ ਦੀ ਟਰੇਨ ਮਿਲੇਗੀ ਕਿ ਜਾਂ ਸਾਨੂੰ ਅੰਮ੍ਰਿਤਸਰ ਜਾਣਾ ਪਵੇਗਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨ ਜਾਣਕਾਰੀ ਦੇਣ ਲਈ